ਆਪਾਂ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਲਈ ਕਾਫ਼ੀ ਉਤਸ਼ਾਹਿਤ ਕਰੀਦਾ ਹੈ ਕਿਉਂਕਿ ਮੈਂ ਆਪ ਖੁਦ ਕਾਫ਼ੀ ਲੰਬੇ ਸਮੇਂ ਤੋਂ ਜੋ ਸਵੇਰੇ ਅਖ਼ਬਾਰ ਪੜ੍ਹਨ ਦਾ ਸ਼ੌਕੀਨ ਹਾਂ ਮੇਰੀ ਆਦਤ ਹੈ ਸਵੇਰੇ ਅਖ਼ਬਾਰ ਪੜ੍ਹਨ ਦੀ ਜੋ ਦੁਨੀਆਦਾਰੀ ਵਿੱਚ ਚੱਲ ਰਿਹਾ ਹੈ ਉਹਦੇ ਬਾਰੇ ਜਾਨਣ ਦੀ ਬੱਚਿਆਂ ਨੂੰ ਵੀ ਅਖ਼ਬਾਰ ਪੜ੍ਹਨ ਦੀ ਜੋ ਆਦਤ ਹੈ ਉਹ ਪਾਉਣੀ ਚਾਹੀਦੀ ਹੈ ਕਿਉਂਕਿ ਅਖ਼ਬਾਰ ਵਿੱਚ ਕਾਫ਼ੀ ਦੇਸ਼ ਦੀਆਂ ਖ਼ਬਰਾਂ ਆਉਂਦੀਆਂ ਹਨ ਸਗੋਂ ਦੇਸ਼ ਦੀਆਂ ਹੀ ਨਹੀਂ ਕਾਫ਼ੀ ਬੱਚਿਆਂ ਦੇ ਪੜ੍ਹਾਈ ਦੀ ਸੰਬੰਧ ਵਿੱਚ ਵੀ ਬੱਚਿਆਂ ਦੀਆਂ ਗੇਮਸ ਦੇ ਪ੍ਰਤੀ ਕਾਫ਼ੀ ਜਾਣਕਾਰੀ 'ਚ ਅਖ਼ਬਾਰਾਂ ਵਿੱਚ ਦਿੱਤੀ ਜਾਂਦੀ ਹੈ ਸਰਕਾਰੀ ਪੇਪਰਾਂ ਦੀਆਂ ਇਸ਼ਤਿਹਾਰਾਂ ਜਾਂ ਨੌਕਰੀ ਦੀਆਂ ਇਸ਼ਤਿਹਾਰਾਂ ਅਖ਼ਬਾਰਾਂ ਵਿੱਚ ਪਾਈਆਂ ਜਾਂਦੀਆਂ ਹਨ ਸੋ ਬੱਚਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਆਪ ਰੋਜ਼ ਅਖ਼ਬਾਰ ਪੜ੍ਹਨ ਅਤੇ ਜੋ ਆਪਣੀ ਜਾਣਕਾਰੀ ਹੈ ਜਰਨਲ ਨੋਲੇਜ ਵਧਾ ਸਕਣ